ਪੇਂਟਿੰਗ ਜਾਂ ਹੱਥ ਨਾਲ ਬਣੇ ਤੋਹਫੇ ਨੇ ਜਾਂ ਕਾਰਡ ਨੇ ਜਾਂ ਕੁਛ ਵੀ ਜੋ ਵੀ ਚੀਜ਼ਾਂ ਬਣਾਉਂਦਾ ਕਲਾ ਦੇ ਰੂਪ ਵਿੱਚ ਵਿਅਕਤੀ ਉਹ ਬਹੁਤ ਜ਼ਿਆਦਾ ਭਾਵਨਾਤਮਕ ਵੀ ਹੁੰਦੀਆਂ ਨੇ ਅਤੇ ਮੁੱਲ ਵੀ ਜ਼ਿਆਦਾ ਹੁੰਦਾ ਜਿਵੇਂ ਦਿਵਾਲੀ ਦੇ ਮੌਕੇ 'ਤੇ ਆਪਾਂ ਦੀਵੇ ਲੈਂਦੇ ਹਾਂ ਜਾਂ ਹੋਰ ਚੀਜ਼ਾਂ ਲੈਂਦੇ ਹਾਂ ਸਜਾਵਟ ਵਾਲੀਆਂ ਉਹਨਾਂ ਦੇ ਉੱਤੇ ਟਾਈਮ ਵੀ ਸਮਾਂ ਵੀ ਬਹੁਤ ਜ਼ਿਆਦਾ ਲੱਗਿਆ ਹੁੰਦਾ ਅਤੇ ਹੱਥਾਂ ਨਾਲ ਬਣੀਆਂ ਹੁੰਦੀਆਂ ਨੇ ਜਿੱਦਾਂ ਮਿੱਟੀ ਰੰਗ ਲੱਗਦਾ ਉਹਨਾਂ ਨੂੰ ਸਜਾਵਟ ਦੇ ਲਈ ਹੋਰ ਵੀ ਸਾਈਜ਼ ਵੀ ਉਹਨਾਂ ਦਾ ਡਿਵੈਲਪ ਕਰਨਾ ਉਹਨਾਂ ਨੇ ਉੱਦਾਂ ਬਣਾਉਣੇ ਨੇ ਅਤੇ ਉਹਨਾਂ ਦਾ ਮੁੱਲ ਹੈ ਜੋ ਜ਼ਿਆਦਾ ਤਾਂ ਹੁੰਦਾ ਕਿਉਂਕਿ ਉਹਨਾਂ 'ਤੇ ਜੋ ਸਮਾਂ ਲੱਗਿਆ ਅਤੇ ਉਸ ਨੂੰ ਬਣਾਉਣ ਉੱਤੇ ਜੋ ਮਟੀਰੀਅਲ ਲੱਗਿਆ ਉਹ ਬਹੁਤ ਜ਼ਿਆਦਾ ਕੀਮਤੀ ਆ ਅਤੇ ਹੁਣ ਬਹੁਤ ਜ਼ਿਆਦਾ ਘੱਟ ਮਿਲਦਾ ਆਪਣੇ ਜਿੱਦਾਂ ਮਿੱਟੀ ਦੇ ਭਾਂਡੇ ਨੇ ਹੋਰ ਬਹੁਤ ਜ਼ਿਆਦਾ ਸਜਾਵਟ ਵਾਲੀਆਂ ਚੀਜ਼ਾਂ ਨੇ ਜਿਨਾਂ ਨੂੰ ਪੇਂਟਿੰਗ ਕਰਕੇ ਬੜੇ ਵਧੀਆ ਤਰੀਕੇ ਦੇ ਨਾਲ ਪੇਸ਼ ਕੀਤਾ ਜਾਂਦਾ